ਹੈਲੋ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੈਂ ਪੇਂਡੂ ਖੇਤਰ ਵਿੱਚ ਖੇਤੀਬਾੜੀ ਉਪਯੋਗ ਦੇ ਸੁਧਾਰ ਲਈ ਬੋਲਣਾ ਚਾਹੁੰਦਾ ਹਾਂ ਜਿਵੇਂ ਕਿ ਅਸੀਂ ਪੇਂਡੂ ਖੇਤਰ ਵਿੱਚ ਫਸਲ ਦੇ ਉੱਤੇ ਖਰਚਾ ਘੱਟ ਕਰਕੇ ਆਮਦਨ ਜ਼ਿਆਦਾ ਕਰਦੇ ਹਾਂ ਵੀ ਆਪਾਂ ਨੂੰ ਖਰਚਾ ਘੱਟ ਹੁੰਦਾ ਹੈ ਅਤੇ ਆਮਦਨ ਜ਼ਿਆਦਾ ਹੁੰਦੀ ਹੈ ਉਸ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਫ਼ਾਇਦਾ ਹੁੰਦਾ ਹੈ ਕਿਉਂਕਿ ਉਸ ਵਿੱਚ ਸਾਨੂੰ ਪੈ ਪੈਸਾ ਦੁੱਗਣਾ ਮਿਲਦਾ ਹੈ ਅਤੇ ਖਰਚਾ ਘੱਟ ਹੁੰਦਾ ਹੈ ਜਿਵੇਂ ਕਿ ਅਸੀਂ ਆਪਣੀ ਫਸਲ ਦੇ ਉੱਤੇ ਕਿਸੇ ਖੇਤੀ ਦੇ ਜਾਣਕਾਰ ਭਾਈਚਾਰਿਆਂ ਦੀ ਮਦਦ ਲੈ ਸਕਦੇ ਹਾਂ ਉਹਨਾਂ ਤੋਂ ਆਪਾਂ ਖੇਤੀਬਾੜੀ ਬਾਰੇ ਪੁੱਛ ਸਕਦੇ ਹਾਂ ਜਿਵੇਂ ਕਿ ਆਪਣੇ ਜਿਲ੍ਹਿਆਂ ਦੇ ਵਿੱਚ ਇੱਕ ਨਾ ਇੱਕ ਖੇਤੀਬਾੜੀ ਮਹਿਕਮਾ ਹੁੰਦਾ ਹੈ ਅਤੇ ਉਸ ਵਿੱਚ ਅਫਸਰ ਲੱਗੇ ਹੁੰਦੇ ਹਨ ਆਪਾਂ ਅਫਸਰਾਂ ਦੀ ਰਾਏ ਲੈ ਸਕਦੇ ਹਾਂ ਵੀ ਖੇਤੀ ਕਿਹੜੇ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਸਾਨੂੰ ਕਿਹੜੀ ਖਾਦ ਪਾਉਣੀ ਚਾਹੀਦੀ ਹੈ ਖੇਤੀ ਵਿੱਚ ਜਾਂ ਕਿਹੜੀ ਸਪਰੇ ਦੀ ਵਰਤੋਂ ਕੀਤੀ ਜਾ ਕੀਤੀ ਜਾਵੇ ਵੀ ਜਿਸ ਨਾਲ ਖਰਚਾ ਵੀ ਘੱਟ ਹੋਵੇ ਅਤੇ ਸਾਨੂੰ ਫ਼ਾਇਦਾ ਜ਼ਿਆਦਾ ਹੋਵੇ ਕਿਉਂਕਿ ਆਪਾਂ ਨੂੰ ਖੇਤੀ ਕਰਨ ਦਾ ਤਾਂਹੀਓਂ ਫ਼ਾਇਦਾ ਵੀ ਆਪਾਂ ਖਰਚਾ ਘੱਟ ਕਰੀਏ ਅਤੇ ਆਮਦਨ ਜ਼ਿਆਦਾ ਕਰੀਏ ਅਤੇ ਇਸ ਲਈ ਸਾਨੂੰ ਆਪਣੇ ਭਾਈਚਾਰਿਆਂ ਦੀ ਰਾਏ ਲੈ ਕੇ ਹੀ ਖੇਤੀ ਖੇਤੀ ਕਰਨੀ ਚਾਹੀਦੀ ਹੈ ਅਤੇ ਉਸ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਵੀ ਕਿੰਨੇ ਏਕੜ ਜਮੀਨ ਹੈ ਅਤੇ ਕਿੰਨਾ ਖਰਚਾ ਹੋਵੇ ਕਿੰਨੀ ਆਮਦਨ ਹੋਵੇ ਉਹ ਆਪਾਂ ਨੂੰ ਸਾਰਾ ਖੇਤੀਬਾੜੀ ਮਹਿਕਮਾ ਦੱਸ ਦਿੰਦਾ ਹੈ ਅਤੇ ਉਹ ਸਰਕਾਰੀ ਅਫਸਰ ਹੁੰਦੇ ਹਨ ਉਹਨਾਂ ਦੀ ਰਾਏ ਲੈਣੀ ਜ਼ਰੂਰੀ ਹੈ ਅਤੇ ਸਾਨੂੰ ਆਪਣੀ ਆਪਣੇ ਖੇਤ ਦਾ ਪਾਣੀ ਦਾ ਟੈਸਟ ਮਿੱਟੀ ਦਾ ਟੈਸਟ ਜਾਂ ਕੋਈ ਹੋਰ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ ਅਤੇ ਜਿਸ ਨਾਲ ਸਾਡੇ ਪਾਣੀ ਦਾ ਪਤਾ ਲੱਗਦਾ ਰਹਿੰਦਾ ਹੈ ਅਤੇ ਮਿੱਟੀ ਦੇ ਕਣਾਂ ਦਾ ਉਹ ਕਣਾਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਕਿ ਇਹ ਫਸਲ ਲਈ ਸਹੀ ਹੈ ਜਾਂ ਗਲਤ ਹੈ ਧੰਨਵਾਦ